ਸਾਡੇ ਖੇਤਰ ਵਿੱਚ ਜਿਵੇਂ ਅੱਜ ਕੱਲ੍ਹ ਔਰਤਾਂ ਨੂੰ ਅਜੇ ਵੀ ਪਹਿਲਾਂ ਵਰਗਾ ਹੀ ਸਮਝਿਆ ਜਾਂਦਾ ਹੈ ਜਿਵੇਂ ਕਿ ਔਰਤਾਂ ਨੂੰ ਘਰ ਵਿੱਚ ਕੰਮ ਕਰਨ ਵਾਲਾ ਹੀ ਸਮਝਿਆ ਜਾਂਦਾ ਹੈ ਅੱਜ ਕੱਲ੍ਹ ਇਹਦਾ ਮਤਲਬ ਇਹ ਕਿ ਜਿਵੇਂ ਪਹਿਲਾਂ ਔਰਤਾਂ ਰਹਿੰਦੀਆਂ ਸੀ ਉੱਦਾਂ ਹੀ ਹੁਣ ਰਹਿੰਦੀਆਂ ਹਨ ਕਈ ਲੋਕ ਤਾਂ ਔਰਤਾਂ ਨੂੰ ਅਜੇ ਵੀ ਪੈਰ ਦੀ ਜੁੱਤੀ ਸਮਝੀ ਜਾਂਦੇ ਹਨ ਕੋ ਕਈ ਉਹਨਾਂ ਨੂੰ ਪੜ੍ਹਾਉਂਦੇ ਲਿਖਾਉਂਦੇ ਨਹੀਂ ਹਨ ਘਰੋਂ ਬਾਹਰ ਵੀ ਨਹੀਂ ਜਾਣ ਦਿੰਦੇ ਹਨ ਪਰ ਜਿਹੜੀਆਂ ਔਰਤਾਂ ਘਰੋਂ ਬਾਹਰ ਜਾਂਦੀਆਂ ਹਨ ਪੜ੍ਹਾਈ ਕਰਨ ਕੰਮ ਕਰਦੀਆਂ ਹਨ ਅਤੇ ਪਰ ਉਹਨਾਂ ਨੂੰ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਔਰਤਾਂ ਨੂੰ ਬੱਸਾਂ ਵਿੱਚ ਜਾਣਾ ਆਉਣਾ ਵੀ ਬੜਾ ਔਖਾ ਲੱਗਦਾ ਹੈ ਅਤੇ ਉਹ ਬੱਸ ਬੱਸਾਂ ਦੇ ਵਿੱਚ ਵੀ ਕਈ ਉਹਨਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇ ਕਈ ਲੋਕ ਤਾਂ ਇੱਦਾਂ ਦੇ ਹਨ ਕਿ ਬੜਾ ਬੁਰਾ ਸਮ ਵ ਗੱਲਾਂ ਕਰਦੇ ਹਨ ਔਰਤਾਂ ਨੂੰ ਇਹ ਕੰਮ ਕਰਦੀਆਂ ਹਨ ਜਿਨ੍ਹਾਂ ਨੇ ਕੰਮ ਕਰਨਾ ਆਪਣਾ ਰੁਜ਼ਗਾਰ ਚਲਾਉਣਾ ਉਹਨਾਂ ਨੇ ਤਾਂ ਜਾਣਾ ਹੀ ਹੈ ਕੰਮ ਕਰਨ ਪਰ ਲੋਕ ਉਹਨਾਂ ਨੂ ਚੰਗਾ ਨਹੀਂ ਸਮਝਦੇ ਅਤੇ ਹੁ ਅੱਜ ਕੱਲ੍ਹ ਦਾ ਇੱਦਾਂ ਦਾ ਜ਼ਮਾਨਾ ਹੈ ਕਿ ਕਈ ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ ਰੱਖਦੇ ਕਈ ਤਾਂ ਔਰਤਾਂ ਨੂੰ ਬਹੁਤ ਹੀ ਸਨਮਾਨ ਦਿੰਦੇ ਹਨ ਅਤੇ ਪਰ ਕਈ ਨਹੀਂ ਦਿੰਦੇ